ਪੰਜਾਬ ਕਿਸੇ ਵੀ ਹੋਰ ਰਾਜ ਨਾਲੋਂ ਪਿੱਛੇ ਨਹੀਂ ਹੈ ਪੰਜਾਬ ਨੂੰ ਹੁਣ ਕੋਈ ਵੀ ਪਿਛੋਕੜ ਵਿੱਚ ਨਹੀਂ ਗਿਣ ਸਕਦਾ ਪੰਜਾਬ ਵਿੱਚ ਹੁਨਰ ਵਿਕਾਸ ਲਈ ਬਹੁਤ ਸਾਰੇ ਕਦਮ ਉਠਾਏ ਜਾ ਰਹੇ ਹਨ ਬਹੁਤ ਸਾਰੇ ਮੌਕੇ ਉਪਲੱਬਧ ਹਨ ਬੱਚਿਆਂ ਨੂੰ ਵੱਖ ਵੱਖ ਸੈਕਟਰਾਂ ਖੇਤੀ ਨਿਰਮਾਣ ਆਈ ਟੀ ਹੋਰ ਵੀ ਸੈਕਟਰਾਂ ਦੀ ਨੌਲੇਜ ਲਈ ਪੰਜਾਬ ਅਤੇ ਪੰਜਾਬ ਦੇ ਸਕੂਲ ਬਹੁਤ ਵਧੀਆ ਗਾਈਡ ਕਰ ਰਹੇ ਹਨ ਜਿਵੇਂ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਪਿਛਲੇ ਦਿਨੋਂ ਹੀ ਮੇਲੇ ਲੱਗੇ ਸਨ ਜਿਹਦੇ ਵਿੱਚ ਪਾਈਟੈਕਸ ਖੇਤਰੀ ਮੇਲਾ ਅਤੇ ਅੱਜ ਕੱਲ੍ਹ ਰੰਗਲਾ ਪੰਜਾਬ ਮੇਲਾ ਵੀ ਲੱਗਿਆ ਹੋਇਆ ਹੈ ਪਾਈਟੈਕਸ ਵਿੱਚ ਵੱਖ ਵੱਖ ਸਕੂਲਾਂ ਨੂੰ ਲੈ ਕੇ ਗਏ ਤਾਂ ਉਹਨਾਂ ਨੂੰ ਨਿਰਮਾਣ ਬਾਰੇ ਟੈਕਨੋਲੋਜੀ ਦੀਆਂ ਗੱਲਾਂ ਬਾਰੇ ਕਾਫੀ ਕੁਛ ਦੱਸਿਆ ਗਿਆ ਖੇਤਰੀ ਮੇਲਾ ਵਿੱਚ ਖੇਤੀਬਾੜੀ ਦੇ ਸਾਰੇ ਟੂਲਸ ਉਹਨਾਂ ਨੂੰ ਦਿਖਾਏ ਗਏ ਅਤੇ ਜਿਸ ਤਰ੍ਹਾਂ ਹੁਣ ਰੰਗਲਾ ਪੰਜਾਬ ਮੇਲਾ ਲੱਗਿਆ ਹੈ ਜਿਹਦੇ ਵਿੱਚ ਪੰਜਾਬ ਦਾ ਕਲਚਰ ਦਿਖਾਇਆ ਜਾ ਰਿਹਾ ਹੈ ਅਤੇ ਬੱਚਿਆਂ ਨੂੰ ਹੋਰ ਵੀ ਚੀਜ਼ਾਂ ਸਿਖਾਉਣ ਲਈ ਜਿਵੇਂ ਇੰਟਰਪਨਿਓਰਸ਼ਿਪ ਡਿਵੈਲਪਮੈਂਟ ਇੰਸਟੀਟਿਊਟ ਵੋਕੇਸ਼ਨਲ ਟ੍ਰੇਨਿੰਗ ਸਕੀਮਸ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਦੇ ਬੱਚੇ ਅੱਗੇ ਵੱਧ ਸਕਣ ਧੰਨਵਾਦ